ਪੰਜਾਬ ਵਿੱਚ ਮਨੋਰੰਜਨ ਦੇ ਕਈ ਸਾਧਨ ਉਪਲੱਬਧ ਹਨ ਅੱਜ ਦੇ ਸਮੇਂ ਵਿੱਚ ਪ ਪੰਜਾਬ ਨੇ ਕਾਫੀ ਤਰੱਕੀ ਕਰ ਲਈ ਹੈ ਅਤੇ ਇਸ ਦੇ ਕਈ ਜ਼ਿਲ੍ਹਿਆਂ ਵਿੱਚ ਕਾਫੀ ਥਿਏਟਰ ਪ੍ਰੋਡਕਸ਼ਨ ਅਤੇ ਇਸ ਤੋਂ ਇਲਾਵਾ ਪੰਜਾਬ ਵਿੱਚ ਵੱਖ ਵੱਖ ਥਾਵਾਂ 'ਤੇ ਆਰਟਸ ਦੀ ਐਗਜੀਬਿਸ਼ਨ ਅਤੇ ਸਿਖਲਾਈ ਵੀ ਕੀਤੀ ਜਾਂਦੀ ਹੈ ਜੋ ਕਿ ਭਾਰਤ ਦੇ ਬਾਕੀ ਰਾਜਾਂ ਨਾਲੋਂ ਬਹੁਤ ਵੱਧ ਹੈ ਜਿਵੇਂ ਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨਾਲੋਂ ਵਿੱਚ ਕਈ ਤਰ੍ਹਾਂ ਨਾਲੋਂ ਪੰਜਾਬ ਵਿੱਚ ਕਈ ਤਰ੍ਹਾਂ ਦੇ ਥਿਏਟਰ ਵੀ ਉਪਲਬਧ ਹਨ ਅਤੇ ਕਈ ਤਰ੍ਹਾਂ ਦੀਆਂ ਆਰਟਸ ਅਕੈਡਮੀਆਂ ਅਤੇ ਸਮੇਂ ਸਮੇਂ ਐਗਜੀਬਿਸ਼ਨ ਲੱਗਦੇ ਹਨ ਜੋ ਕਿ ਕਾਫੀ ਰਾਜਾਂ ਨਾਲੋਂ ਪੰਜਾਬ ਕਾਫੀ ਅੱਗੇ ਹੈ